ਅਸੀਂ ਜੇ ਅੱਜ ਔਰਤਾਂ ਦੀ ਸਥਿਤੀ ਨੂੰ ਦੇਖੀਏ ਅਤੇ ਪਹਿਲਾਂ ਦੀ ਸਥਿਤੀ ਨੂੰ ਦੇਖੀਏ ਥੋੜ੍ਹਾ ਬਹੁਤ ਫ਼ਰਕ ਪਿਆ ਫ਼ਰਕ ਨਹੀਂ ਵੀ ਪਿਆ ਪਹਿਲਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਹੈਨਾ ਵੋਟ ਦਾ ਅਧਿਕਾਰ ਨਹੀਂ ਹੁੰਦਾ ਸੀ ਅਤੇ ਜਿਸ ਹਿਸਾਬ ਨਾਲ ਔਰਤਾਂ ਆਪਣੇ ਲਈ ਲੜੀਆਂ ਹੱਕ ਲਈ ਖੜ੍ਹੀਆਂ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਨੇ ਅਤੇ ਵੋਟ ਦਾ ਅਧਿਕਾਰ ਮਿਲਿਆ ਪਰ ਫਿਰ ਵੀ ਚੰਗੀ ਤਰ੍ਹਾਂ ਸੁਰੱਖਿਅਤ ਨਹੀਂ ਹੈਗੀਆਂ ਉਹਨਾਂ ਨੇ ਆਪਣੇ ਜੀਵਨ ਲਈ ਬਹੁਤ ਮੁਸ਼ੱਕਤ ਕੀਤੀ ਹੈ ਮਿਹਨਤ ਕੀਤੀ ਹੈ ਤਾਂ ਇੱਥੇ ਆਈਆਂ ਨੇ ਪਰ ਜੇ ਦੇਖਿਆ ਜਾਵੇ ਹਜੇ ਵੀ ਔਰਤ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹਰੇਕ ਇਲਜ਼ਾਮ ਔਰਤ 'ਤੇ ਔਰਤ ਨੂੰ ਗਲਤ ਨਿਗ੍ਹਾ ਨਾਲ ਦੇਖਿਆ ਜਾਂਦਾ ਔਰਤ ਨੂੰ ਬਹੁਤਾ ਸ ਸਮਾਜ 'ਚ ਚੰਗਾ ਨਹੀਂ ਸਮਝਿਆ ਜਾਂਦਾ ਹਜੇ ਵੀ ਉਹਦੀਆਂ ਬਹੁਤੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਮੰਨੀਆਂ ਜਾਂਦੀਆਂ ਪਰ ਸਮਾਜ ਜਿੰਨਾ ਮਰਜ਼ੀ ਅੱਗੇ ਵਰਜੇ ਤਕਨੀਕ ਵਜੋਂ ਵਰਜੇ ਹੈ ਨਾ ਵਿਗਿਆਨ ਬਸ ਪਾਸੋਂ ਵਰਜੇ ਪਰ ਜ਼ਿੰਦਗੀ 'ਚ ਔਰਤ ਨੂੰ ਫਿਰ ਵੀ ਨੀਵਾਂ ਹੀ ਸਮਝਿਆ ਜਾਂਦਾ ਹੈ ਅਤੇ ਸਾਡੇ ਹਿਸਾਬ ਨਾਲ ਤਾਂ ਔਰਤ ਨੂੰ ਨੀਵਾਂ ਹੀ ਸਮਝਿਆ ਜਾ ਜਾਂਦਾ ਰਿਹਾ ਹੈ ਜਾਂ ਸਮਝਿਆ ਜਾਂਦਾ ਰਹੂਗਾ ਪਰ ਜੋ ਕਿ ਗਲਤ ਗੱਲ ਹੈ